ਮੈਂ ਰੋਪੜ ਦੇ ਪਰਚੂਨ ਅਤੇ ਥੋਕ ਬਾਜ਼ਰਾਂ ਬਾਰੇ ਜਾਣਦੀ ਹਾਂ ਇੱਥੋਂ ਦੇ ਬਾਜ਼ਾਰ ਬਹੁਤ ਸਰਗਰਮ ਹਨ ਅਤੇ ਕੀਮਤਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋਈ ਜਾਂਦਾ ਹੈ ਥੋਕ ਬਾਜ਼ਾਰ ਵਿੱਚ ਬਹੁਤ ਹੀ ਜਾਇਜ਼ ਕੀਮਤਾਂ 'ਤੇ ਸਮਾਨ ਉਪਲਬਧ ਹੁੰਦਾ ਹੈ ਹਾਲ ਹੀ ਵਿੱਚ ਪੰਜਾਬ ਵਿੱਚ ਹੜ੍ਹ ਆਉਣ ਦੇ ਕਾਰਨ ਇਸ ਸਾਲ ਬਾਰਿਸ਼ ਸਮੇਂ ਤੋਂ ਪਹਿਲਾਂ ਹੋ ਗਈ ਜਿਸ ਕਾਰਨ ਹੜ੍ਹ ਦੀ ਸਮੱਸਿਆ ਵੱਧ ਗਈ ਇਸ ਕਰਕੇ ਸਬਜ਼ੀਆਂ ਦੀ ਫਸਲ ਖਰਾਬ ਹੋ ਗਈ ਅਤੇ ਸਬਜ਼ੀਆਂ ਅਤੇ ਕਰਿਆਨੇ ਦੇ ਦੀਆਂ ਕੀਮਤਾਂ ਵੱਧ ਗਈਆਂ ਕਿਉਂਕਿ ਹੜ੍ਹ ਆਉਣ ਕਾਰਨ ਟਰਾਂਸਪੋਰਟ ਦਾ ਕੰਮ ਵੀ ਠੱਪ ਹੋ ਗਿਆ ਇਸ ਕਰਕੇ ਕੀਮਤਾਂ ਵੱਧ ਗਈਆਂ ਔਨਲਾਈਨ ਖਰੀਦਦਾਰੀ ਦੇ ਕਈ ਮਾੜੇ ਅਤੇ ਚੰਗੇ ਪ੍ਰਭਾਵ ਹਨ ਚੰਗੇ ਪ੍ਰਭਾਵ ਇਹ ਹਨ ਇਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਮਾਨਸਿਕ ਤਣਾਵ ਘੱਟ ਹੁੰਦਾ ਹੈ ਕੋਈ ਵੀ ਆਰਡਰ ਕੀਤਾ ਸਮਾਨ ਆਸਾਨੀ ਨਾਲ ਘਰ ਪਹੁੰਚ ਜਾਦਾ ਹੈ ਇਸ ਦੇ ਮਾੜੇ ਪ੍ਰਭਾਵ ਇਹ ਹਨ ਕਿ ਜੋ ਗਰੀਬ ਅਤੇ ਛੋਟੇ ਕਾਰ ਕਾਰੋਬਾਰ ਵਾਲੇ ਲੋਕ ਹਨ ਉਨ੍ਹਾਂ ਉਨ੍ਹਾਂ ਲਈ ਮੁਸੀਬਤਾਂ ਵੱਧ ਗਈਆਂ ਹਨ ਧੰਨਵਾਦ